ਪੰਜਾਬ ਵਿੱਚ ਗੇਮ ਡਿਵਲਪਮੈਂਟ ਅਤੇ ਡਿਜ਼ਾਇਨ ਦੇ ਖੇਤਰ ਵਿੱਚ ਸਰਕਾਰ ਵੱਲੋਂ ਬਹੁਤ ਸਹਾਇਤਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਵੇਂ ਨਵੇਂ ਸਟੇਡੀਅਮ ਬਣਾਏ ਜਾ ਰਹੇ ਹਨ ਨਵੇਂ ਨਵੇਂ ਕੋਚਿਜ ਆਏ ਬੁਲਾਏ ਜਾ ਰਹੇ ਹਨ ਜਿਹੜੇ ਕਿ ਖਿਡਾਰੀਆਂ ਨੂੰ ਉੱਚ ਪੱਧਰ ਦੀ ਟ੍ਰੇਨਿੰਗ ਦਿੰਦੇ ਹਨ ਕਿ ਉਹ ਅੱਗੇ ਜਾ ਕੇ ਓਲੰਪਿਕਸ 'ਚ ਜਾ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਜਿਵੇਂ ਕਿ ਅੱਜ ਕੱਲ੍ਹ ਪੰਜਾਬ ਦੇ ਖਿਡਾਰੀ ਹਰ ਪਾਸੇ ਛਾਏ ਹੋਏ ਹਨ ਕ੍ਰਿਕਟ ਜਗਤ ਵਿੱਚ ਸ਼ੁਭਮਨ ਗਿੱਲ ਨਿਹਾਲ ਵੱਡੇਰਾ ਅਤੇ ਹੋਰ ਵੀ ਬਹੁਤ ਨਾਮ ਹਨ ਅਤੇ ਉਹ ਅੱਗੇ ਜਾ ਕੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀਆਂ ਵਿੱਚ ਸਕੂਲਾਂ ਵਿੱਚ ਅਤੇ ਸਰਕਾਰੀ ਨੌਕਰੀਆਂ ਵਿੱਚ ਖੇਡ ਕੋਟਾ ਵੀ ਬਣਾਇਆ ਗਿਆ ਹੈ ਜਿਸ ਵਿੱਚ ਖਿਡਾਰੀ ਜੋ ਹੁੰਦੇ ਹਨ ਉਹ ਸੌਖੇ ਤਰੀਕੇ ਨਾਲ ਐਡਮਿਸ਼ਨ ਲੈ ਪਾਉਂਦੇ ਹਨ ਸਕੂਲ ਕਾਲਜਾਂ ਦੇ ਵਿੱਚ ਅਤੇ ਉਹ ਅੱਗੇ ਜਾ ਕੇ ਅੱਗੇ ਦੀ ਅੱਗੇ ਜਿਵੇਂ ਇੰਟਰ ਕਾਲਜ ਕੰਪਟੀਸ਼ਨਸ ਹੁੰਦੇ ਹਨ ਅਤੇ ਨੈਸ਼ਨਲ ਡਿਸਟਰਿਕ ਲੈਵਲ ਅਤੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਆਪਣੇ ਕਾਲਜ ਦਾ ਆਪਣੇ ਪੰਜਾਬ ਦਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ ਪੰਜਾਬ ਸਰਕਾਰ ਗੇਮਿੰਗ ਖੇਤਰ ਵਿੱਚ ਨਿਵੇਸ਼ ਵੀ ਬਹੁਤ ਕਰ ਰਹੀ ਹੈ ਜਿਵੇਂ ਕਿ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਖੇਡ ਦੀ ਖੇਡ ਦੀਆਂ ਚੀਜ਼ਾਂ ਦਾ ਬਹੁਤ ਨਿਵੇਸ਼ ਹੋ ਰਿਹਾ ਹੈ ਜਿਸ ਨਾਲ ਕਿ ਜਿਵੇਂ ਜਲੰਧਰ ਦੇ ਵਿੱਚ ਖੇਡਾਂ ਦਾ ਸਮਾਨ ਬਣਦਾ ਹੈ ਅਤੇ ਉਹ ਪੂਰੇ ਦੁਨੀਆਂ ਵਿੱਚ ਇੰਪੋਰਟ ਕੀਤਾ ਜਾਂਦਾ ਹੈ ਅਤੇ ਲੁਧਿਆਣੇ ਵਿੱਚ ਬਣਨ ਵਾਲੇ ਸਾਈਕਲ ਉਹਨਾਂ ਦਾ ਪੂਰੇ ਸੰਸਾਰ ਵਿੱਚ ਬੋਲਬਾਲਾ ਹੈ ਅਤੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਉੱਚ ਪੱਧਰੀਆਂ ਵੀ ਦਿੱਤੀਆਂ ਜਾਂਦੀਆਂ ਹਨ ਨੌਕਰੀ ਦੀਆਂ ਜਿਹਦੇ ਨਾਲ ਸਾਡੇ ਖਿਡਾਰੀ ਜੋ ਹੁੰਦੇ ਹਨ ਉਹ ਹੋਰ ਉਤਸੁਕ ਹੁੰਦੇ ਹਨ ਅਤੇ ਹੋਰ ਖੁਸ਼ੀ ਨਾਲ ਅੱਗੇ ਜਾ ਕੇ ਆਪਣੇ ਦੇਸ਼ ਦਾ ਆਪਣਾ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਦੇ ਹਨ